ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਇਹ ਅਭਿਆਸ ਦੀ ਪਾਲਣਾ ਕਰਨੀ ਚਾਹੀਦੀ ਹੈ ਘਰਾਂ ਵਿੱਚ ਪਾਣੀ ਖੜਾ ਨਾ ਹੋਵੇ ਘਰ ਵਿੱਚ ਸਾਫ਼ ਸਫਾਈ ਹੋਵੇ ਖਾਣਾ ਸਾਫ਼ ਅਤੇ ਪੋਸ਼ਟਿਕ ਹੋਵੇ ਸਮੇਂ ਸਮੇਂ 'ਤੇ ਡਾਕਟਰੀ ਜਾਂਚ ਹੋਵੇ ਅਤੇ ਘਰਾਂ ਵਿੱਚ ਕਬਾੜ ਆਦਿ ਨਾ ਹੋਵੇ ਬਾਹਰ ਤੋਂ ਕੁਝ ਖਾਣਾ ਨਾ ਖਾਓ